ਇੱਕ ਜੀਰੋ ਜੀਰੋ ਇੱਕ ਇੱਕ ਜੀਰੋ ਜੀਰੋ ਤਿੰਨ ਇੱਕ ਜੀਰੋ ਜੀਰੋ ਸੱਤ ਇੱਕ ਜੀਰੋ ਜੀਰੋ ਅੱਠ ਇੱਕ ਜੀਰੋ ਜੀਰੋ ਨੌਂ